ਇੱਕ ਬਾਈਕਰ ਦੇ ਕੋਲ ਸਭ ਤੋਂ ਪਹਿਲਾਂ ਤਾਂ ਜਿਹੜੇ ਰੂਲ ਉਹਨੂੰ ਫੋਲੋ ਕਰਨੇ ਚਾਹੀਦੇ ਹਨ ਜੇ ਤਾਂ ਉਹ ਮਤਲਬ ਸਭ ਤੋਂ ਪਹਿਲਾਂ ਤਾਂ ਕੀ ਹੈ ਸਾਨੂੰ ਹੈਲਮੈਟ ਕੈਰੀ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਹਿੰਦੇ ਨੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਸਾਨੂੰ ਜਿਹੜੀ ਡਾਕੂਮੈਂਟ ਜਿਹੜੇ ਦਸਤਾਵੇਜ਼ ਨੇ ਜਿਹੜੇ ਸਾਡੇ ਨਾਲ ਰੱਖਣੇ ਚਾਹੀਦੇ ਹਨ ਉਹ ਹੈ ਜਿਵੇਂ ਕਿ ਸਾਡੀ ਗੱਡੀ ਦੀ ਇਨਸ਼ੋਰੈਂਸ ਉਹਦੀ ਆਰਸੀ ਗੱਡੀ ਸਾਡੀ ਬਾਈਕ ਦਾ ਪੋਲਿਊਸ਼ਨ ਉਸ ਤੋਂ ਬਾਅਦ ਆ ਅਤੇ ਉਹਦੀ ਰਜਿਸਟਰੇਸ਼ਨ ਉਹਦੇ ਸਾਰੇ ਕਾਗਜ਼ ਦਸਤਾਵੇਜ਼ ਅਤੇ ਆਹ ਚੀਜ਼ਾਂ ਜਿਹੜੀ ਹੁੰਦੀ ਹੈ ਬਹੁਤ ਜ਼ਰੂਰੀਆਂ ਹੁੰਦੀ ਸਾਨੂ ਟਾਈਮ ਟੂ ਟਾਈਮ ਗੱਡੀ ਦਾ ਪੋਲਿਊਸ਼ਨ ਗੱਡੀ ਦੀ ਇੰਸ਼ੋਰੈਂਸ ਕਰਾਉਂਦੇ ਰਹਿਣਾ ਚਾਹੀਦਾ ਹੈ ਉਹਦੇ ਨਾਲ ਕੀ ਹੈਗਾ ਕਿ ਅਸੀਂ ਚਲਾਨ ਤੋਂ ਬਚੇ ਰਹਾਂਗੇ ਪਲਸ ਜੇ ਕੱਲ੍ਹ ਨੂੰ ਕੋਈ ਹਾਦਸਾ ਹੁੰਦਾ ਹੈ ਅਤੇ ਉਹ ਇੰਸ਼ੋਰੈਂਸ ਵਿੱਚ ਕਵਰ ਹੋ ਜਾਂਦਾ ਅਤੇ ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕੀ ਜੇ ਆਪਾਂ ਇਹਦੇ ਵਿੱਚ ਕੋਈ ਵੀ ਡਾਕੂਮੈਂਟ ਨਹੀਂ ਰੱਖਾਂਗੇ ਅਤੇ ਉਹਦੇ ਇੱਕ ਭਾਰੀ ਚਲਾਨ ਸਾਨੂੰ ਭਰਨਾ ਪਏਗਾ ਅਤੇ ਜਦ ਆਪਾਂ ਬਾਈਕ ਚਲਾਉਂਦੇ ਆ ਸਭ ਤੋਂ ਪਹਿਲਾਂ ਕੀ ਹੈ ਸਾਨੂੰ ਅਤੇ ਆਪਣੀਆਂ ਜਿਹੜੀ ਟਰੈਫਿਕ ਲਾਈਟਾਂ ਹੁੰਦੀ ਆ ਉਹਦਾ ਪਾਲਨਾ ਕਰਨਾ ਚਾਹੀਦਾ ਜਦ ਲਾਲ ਬੱਤੀ ਹੁੰਦੀ ਹੈ ਅਤੇ ਉਸ ਸਮੇਂ ਰੁਕ ਜਾਣਾ ਚਾਹੀਦਾ ਹੈ ਅਤੇ ਜੇ ਜੈਬਰਾ ਕੋਰਸਿੰਗ ਤਾਂ ਤੁਸੀਂ ਦਿਖਦੇ ਓ ਤਾਂ ਉਸ ਤੋਂ ਪਹਿਲਾਂ ਹੀ ਆਪਣੀ ਆਪਣੀ ਬਾਈਕ ਜਿਹੜੀ ਤੁਸੀਂ ਰੋਕ ਲਵੋ ਅਤੇ ਜਿਹੜੀ ਆਪਣੀ ਬਾਈਕ ਦੀ ਸਪੀਡ ਹੈਗੀ ਆ ਉਹ ਤੁਸੀਂ ਨੋਰਮਲੀ ਚਾਲ੍ਹੀ ਤੋਂ ਸੱਠ ਦੇ ਵਿੱਚ ਕਾਰ ਚਲਾਓ ਅਤੇ ਉਹਨੂੰ ਤੁਸੀਂ ਆਰਾਮ ਨਾਲ ਵਰਤੋਂ ਨਾ ਕਿ ਉਹਨੂੰ ਤੁਸੀਂ ਓਵਰ ਸਪੀਟਿੰਗ ਕਰਕੇ ਕਿਸੇ ਦਾ ਨੁਕਸਾਨ ਕਰੋ ਇਹ ਬਾਈਕ ਚਲਾਉਣ ਦੇ ਮੁਖ ਹੱਦ ਤਾਂ ਹੈ ਇੱਕ ਗੱਲ ਹੋਰ ਜਦ ਆਪਾਂ ਸਵੇਰੇ ਬਾਈਕ ਸਟਾਰਟ ਕਰਦੇ ਹਾਂ ਆਪਾਂ ਉਹਨੂੰ ਸੈਲਫ ਦੇ ਨਾਲ ਨਹੀਂ ਉਹਨੂੰ ਕਿੱਕ ਦੇ ਨਾਲ ਸਟਾਰਟ ਕਰਦੇ ਤਾਂ ਜੋ ਸਾਡੀ ਜਿਹੜੀ ਬਾਈਕ ਦੀ ਜਿਹੜੀ ਬੈਟਰੀ ਆ ਉਹ ਲੰਬੇ ਸਮੇਂ ਚਲਦੀ ਹੈ ਅਤੇ ਉਸ ਤੋਂ ਬਾਅਦ ਜਦ ਆਪਾਂ ਬਾਈਕ ਚਲਾਉਂਦੇ ਹਾਂ ਅਤੇ ਆਪਾਂ ਨੂੰ ਉਹਦੇ ਪੈਟਰੋਲ ਦੀ ਸੂਈ ਵੱਲ ਵੀ ਧਿਆਨ ਰੱਖਣਾ ਚਾਹੀਦਾ ਤਾਂ ਸ ਜੋ ਕਿ ਸਾਨੂੰ ਅੱਗੇ ਜਾ ਕੇ ਉੱਥੇ ਸਾਡੀ ਬਾਈਕ ਨਾ ਰੁੱਕ ਜਾਵੇ ਟਾਈਮ ਟੂ ਟਾਈਮ ਆਪਾਂ ਆਪਣੇ ਗੱਡੀ ਦੇ ਵਿੱਚ ਤੇਲ ਵੀ ਪਵਾਉਂਦੇ ਰਹਿਣਾ ਚਾਹੀਦਾ ਇਹ ਬਾਈਕ ਚਲਾਉਣ ਦੀ ਮੇਨ ਹਦਾਇਤਾਂ ਨੇ ਅਤੇ ਆਪਾਂ ਨੂੰ ਜਿਹੜੇ ਆਪਣੇ ਟਰੈਫਿਕ ਪਾਲਣ ਹੈ ਅਤੇ ਰੂ ਹੈ ਉਹ ਸਾਨੂੰ ਚੱਜ ਨਾਲ ਫੋਲੋ ਕਰਨੇ ਚਾਹੀਦੇ ਹਨ ਜਿੱਦਾਂ ਸਪੀਡ ਲਿਮਿਟ ਹੋ ਗਿਆ ਟਰੈ ਆਪਣਾ ਸਾਇੰਨਜ਼ ਹੋ ਗਏ ਕਰੋਸਿੰਗ ਨਹੀਂ ਕਰਨੀ ਚਾਹੀਦੀ ਓਵਰਟੇਕਿੰਗ ਨਹੀਂ ਕਰਨੀ ਚਾਹੀਦੀ ਆਰਾਮ ਨਾਲ ਆਪਣੀ ਬਾਈਕ ਚਲਾਉਣੀ ਚਾਹੀਦੀ ਹੈ